ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬੇਨਤੀ ਸੀ ਜੀ ਆਪਾਂ ਨੂੰ ਮਕਾਨ ਚਾਹੀਦਾ ਸੀ ਜੀ ਕੋਈ ਰੈਂਟ 'ਤੇ ਜਾਂ ਜਾਂ ਖਰੀਦਣ ਵਾਸਤੇ ਸਾਡੇ ਚਾਰ ਪੰਜ ਜੀਅ ਆ ਉਹਨਾਂ ਵਾਸਤੇ ਠੀਕ ਜਿਹੇ ਅ ਹਿਸਾਬ ਦਾ ਹੋਵੇ ਮਕਾਨ ਦੋ ਕਮਰੇ ਰਸੋਈ ਬੈਡ ਰੂਮ ਬੈਡਰੂਮ ਬਾਥਰੂਮ ਅਟੈਚ ਬਾਥਰੂਮ ਹੋਵੇ ਲੋਬੀ ਅਤੇ ਉਹ ਡਰਾਇੰਗ ਰੂਮ ਵੀ ਨਾਲ ਹੋਵੇ ਹਾਂਜੀ ਕਿੰਨ ਸਾਡੀ ਹੈਸੀਅਤ ਪੰਜ ਕੁ ਲੱਖ ਤੱਕ ਹੈ ਜੀ ਹਾਂਜੀ

ਜੋ ਸਾਨੂੰ ਸਰ ਹਾਂਜੀ ਰੈਂਟ 'ਤੇ ਸਾਨੂੰ ਦਵਾ ਦਿਓ

ਦੋ ਹਜ਼ਾਰ ਰੁਪਈਆ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਜੀ ਹੋ ਮਤਲਬ ਜਿੰਨੀ ਕੁ ਅਸੀਂ ਭਰ ਸਕਦੇ ਹੋਈਏ ਹਾਂਜੀ ਜਾਂ ਫਿ ਜਾਂ ਫਿਰ ਪੰਜ ਲੱਖ ਰੁਪਈਆ ਅਸੀਂ ਕੀਮਤ ਭਰ ਦੇਵਾਂਗੇ ਖੁਦ ਉਸ ਮਕਾਨ 'ਤੇ ਹੀ ਲੋਨ ਹੋ ਜਾਵੇ

ਹਾਂਜੀ ਅਤੇ ਪਾਣੀ ਦਾ ਪ੍ਰਬੰਧ ਸਹੀ ਤਰੀਕੇ ਨਾਲ ਹੋਵੇ ਜੀ ਉੱਥੇ ਹਾਂਜੀ ਪਾਣੀ ਦਾ ਲਾਈਟ ਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੀ ਸਹੂਲਤ ਸਹੀ ਸਾਰੀ ਸਹੂਲਤ ਉੱਥੇ ਵਧੀਆ ਹੋਵੇ ਨਾ ਬੱਚੇ ਆ ਬੱਚਿਆਂ ਦੇ ਆਉਣ ਜਾਣ ਦਾ ਸਕੂਲ ਦਾ ਸਹੀ ਸਿਸਟਮ ਹੋਵੇ ਨਾ ਹਾਂਜੀ ਘਰ ਹਵਾਦਾਰ ਹੋਵੇ ਬੰਦ ਨਾ ਹੋਵੇ ਮਤਲਬ ਖੁੱਲ੍ਹਾ ਅਤੇ ਹਵਾਦਾਰ ਹੋਵੇ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ